ਭਾਸ਼ਾ ਕਿਸੇ ਵੀ ਖਿੱਤੇ ਦੀ ਕਿਸੇ ਵੀ ਵਿਅਕਤੀ ਦੀ ਆਪਣੀ ਇੱਕ ਵੱਖਰੀ ਜਿਹੜੀ ਪਛਾਣ ਹੈ ਉਹ ਪੇਸ਼ ਕਰਦੀ ਹੈ ਜਿਸ ਵੀ ਭਾਸ਼ਾ ਨਾਲ ਜਾਂ ਜਿਸ ਵੀ ਖੇਤਰ ਨਾਲ ਕੋਈ ਵੀ ਵਿਅਕਤੀ ਸੰਬੰਧਿਤ ਹੁੰਦਾ ਤਾਂ ਉਹ ਓਥੋਂ ਦੀ ਹੀ ਭਾਸ਼ਾ ਜਿਹੜੀ ਉਹਦੀ ਜਿਵੇਂ ਮਾਂ ਬੋਲੀ ਆਪਾਂ ਕਹਿੰਦੇ ਤਾਂ ਉਹ ਉਹਦੀ ਇੱਕ ਵੱਖਰੀ ਪਛਾਣ ਹੈ ਜਿਹੜੀ ਉਹ ਨਿਸ਼ਚਿਤ ਕਰਦੀ ਆ ਤਾਂ ਪੰਜਾਬੀ ਭਾਸ਼ਾ ਵੀ ਪੰਜਾਬੀ ਖਿੱਤੇ ਦੀ ਇੱਕ ਵੱਖਰੀ ਪਛਾਣ ਨਾਲ ਜੁੜੀ ਹੋਈ ਆ ਪੰਜਾਬੀ ਲੋਕਾਂ ਦੀ ਪੰਜਾਬੀ ਬੋਲੀ ਹੈ ਜਿਹੜੀ ਉਨ੍ਹਾਂ ਦੀ ਇੱਕ ਸਾਨੂੰ ਦੂਸਰਿਆਂ ਨਾਲੋਂ ਜਿਹੜੀ ਉਹ ਅਲੱਗ ਕਰਦੀ ਆ ਤਾਂ ਪੰਜਾਬੀ ਭਾਸ਼ਾ ਦੀ ਵਰਤੋਂ ਪੰਜਾਬੀ ਭਾਸ਼ਾ ਬੋਲਣ ਵਾਲੇ ਕਿਉਂਕਿ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਇੱਕ ਪੰਜਾਬ ਖਿੱਤੇ ਦੀ ਭਾਸ਼ਾ ਪਰ ਉਹਦੀਆਂ ਵੀ ਅਲੱਗ ਅਲੱਗ ਜਿਹੜੀਆਂ ਖੇਤਰ ਦੇ ਹਿਸਾਬ ਨਾਲ ਉਹਦੇ ਵਿੱਚ ਵੰਨਗੀਆਂ ਮਿਲਦੀਆਂ ਜਿਨ੍ਹਾਂ ਨੂੰ ਅਸੀਂ ਮਲਵਈ ਮਾਝੀ ਪੁਆਧੀ ਦੁਆਬੀ ਆਦਿ ਨਾਲ ਜਾਣਦੇ ਹਾਂ ਤਾਂ ਜਿਹੜੇ ਖੇਤਰ ਨਾਲ ਤਾਂ ਇਨ੍ਹਾਂ ਭਾਸ਼ਾਵਾਂ ਦੇ ਵਿੱਚ ਵੀ ਕੁਛ ਕੁ ਲੋਕ ਬੋਲੀਆਂ ਨੇ ਜਿਹੜੀਆਂ ਖਾਸਕਰ ਪਿੰਡਾਂ ਵਿੱਚ ਰਹਿਣ ਵਾਲੇ ਜਾਂ ਉਨ੍ਹਾਂ ਦੇ ਕੰਮ ਧੰਦੇ ਨਾਲ ਸੰਬੰਧਿਤ ਜਿਹੜੀ ਭਾਸ਼ਾ ਤਾਂ ਉਨ੍ਹਾਂ ਨੂੰ ਅਸੀਂ ਇੱਕ ਖੇਤਰ ਦੀ ਆਂਚਲਿਕ ਭਾਸ਼ਾ ਦੇ ਤੌਰ 'ਤੇ ਵੀ ਜਿਹੜਾ ਉਹ ਜਾਣਿਆ ਜਾਂਦਾ ਤਾਂ ਆਪਣੀ ਪਹਿਚਾਣ ਨੂੰ ਪ੍ਰਗਟ ਕਰਨ ਲਈ ਜਾਂ ਆਪਣੀ ਭਾਵਨਾ ਨੂੰ ਪ੍ਰਗਟ ਕਰਨ ਲਈ ਤਾਂ ਜਿਹੜਾ ਖਾਸ ਕਰਕੇ ਜਿਹੜਾ ਪੇਂਡੂ ਬੰਦਾ ਪੰਜਾਬ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਰਹਿੰਦਾ ਬੰਦਾ ਉਹ ਆਪਣੇ ਇਲਾਕੇ ਨਾਲ ਸੰਬੰਧਿਤ ਜਿਹੜੀ ਬੋਲੀ ਬੋਲ ਕੇ ਮਾਣ ਮਹਿਸੂਸ ਕਰਦਾ ਕਿਉਂਕਿ ਉਹ ਭਾਸ਼ਾ ਜਿਹੜੀ ਉਹਦੀਆਂ ਭਾਵਨਾਵਾਂ ਨਾਲ ਵੀ ਜੁੜੀ ਹੋਈ ਹੈ ਉਹਦੀ ਮਾਨਸਿਕ ਜਿਹੜੀ ਇੱਕ ਸਕੂਨ ਕਹਿ ਲਓ ਉਹਦੇ ਨਾਲ ਵੀ ਜੁੜੀ ਹੋਈ ਹੈ ਉਨ੍ਹਾਂ ਨੂੰ ਓਹੀ ਭਾਸ਼ਾ ਬੋਲ ਕੇ ਤਾਂ ਓਸੇ ਭਾਸ਼ਾ ਵਿੱਚ ਕੰਮ ਕਰਕੇ ਇੱਕ ਮਾਣ ਵੀ ਮਹਿਸੂਸ ਹੁੰਦਾ ਅਤੇ ਉਹ ਆਪਣੀ ਪਛਾਣ ਨੂੰ ਸਾਬਿਤ ਕਰਨ ਲਈ ਜਾਂ ਪਛਾਣ ਦੇ ਮਾਣ ਨਾਲ ਵੀ ਇੱਕ ਜਿਹੜੀ ਆਪਣੀ ਉਹ ਹੈ ਜਿਹੜੀ ਬੋਲੀ ਹੈ ਉਹਨੂੰ ਬੋਲਦਾ